ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਸਵਿਗੀ ਤੋਂ ਬੋਲ ਰਹੇ ਹੋ ਮੈਂ ਗਗਨਦੀਪ ਕੌਰ ਹਾਊਸ ਨੰਬਰ ਛੇ ਸੱਤ ਪੰਜ ਤੋਂ ਪਿੰਡ ਝੁੰਬਾ ਤੋਂ ਗੱਲ ਕਰ ਰਹੀ ਹਾਂ ਅਸੀਂ ਇੱਕ ਔਡਰ ਪਲੇਸ ਕੀਤਾ ਸੀ ਔਡਰ ਨੰਬਰ ਹੈ ਵਨ ਟੂ ਅਸੀਂ ਇਹ ਤਕਰੀਬਨ ਨੌਂ ਵਜੇ ਕੀਤਾ ਸੀਗਾ ਅਸੀਂ ਸਾਡੇ ਘਰ ਅਚਾਨਕ ਕੋਈ ਰਿਸ਼ਤੇਦਾਰ ਆ ਗਏ ਉਹ ਤਾਂ ਕੀਤਾ ਸੀਗਾ ਅਤੇ ਹੁਣ ਦਸ ਵੱਜ ਚੁੱਕੇ ਆ ਤੁਸੀਂ ਇਹ ਕਿਹਾ ਸੀਗਾ ਕਿ ਤੀਹ ਮਿੰਟ ਦੇ ਵਿੱਚ ਵਿੱਚ ਤੁਹਾਡਾ ਔਡਰ ਆ ਜਾਵੇਗਾ ਜਦੋਂ ਮੈਂ ਐਪ ਚੈੱਕ ਕੀਤੀ ਤਾਂ ਉਸ ਦੇ ਉੱਪਰ ਸਾਡਾ ਜਿਹੜਾ ਔਡਰ ਆ ਉਹ ਡਿਲੀਵਰ ਦਿਖਾ ਰਹੇ ਹੈ ਬਟ ਹਜੇ ਤੱਕ ਪਹੁੰਚਿਆ ਹੀ ਨਹੀਂ ਉਹ ਸਾਡੇ ਕੋਲ ਤਾਂ ਤੁਸੀਂ ਪਲੀਜ਼ ਇਸ ਦੇ ਬਾਰੇ ਕੋਈ ਜਾਣਕਾਰੀ ਦੇਖੋ ਵੀ ਕਿੱਥੇ ਪਹੁੰਚਿਆ ਔਡਰ ਕਿ ਕਿਤੇ ਮਤਲਬ ਗੁੰਮ ਹੋ ਗਿਆ ਜਾਂ ਕਿਤੇ ਗਲਤ ਜਗ੍ਹਾ 'ਤੇ ਪਹੁੰਚ ਗਿਆ ਅਗਰ ਤੁਸੀਂ ਇਹ ਨਹੀਂ ਪਹੁੰਚਾ ਸਕਦੇ ਔਡਰ ਤਾਂ ਤੁਸੀਂ ਸਾਡਾ ਔਡਰ ਰੱਦ ਕੀਤਾ ਜਾਵੇ ਅਗਰ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਪਹੁੰਚਾ ਸਕਦੇ ਦੱਸ ਤੋਂ ਪੰਦਰਾਂ ਮਿੰਟ ਦੇ ਵਿੱਚ ਵਿੱਚ ਤੁਹਾਡਾ ਉਹ ਤੁਸੀਂ ਔਡਰ ਸਾਡੇ ਵੱਲ ਪਹੁੰਚਾ ਦਿਓ ਇਸ ਤੋਂ ਅ ਮਤਲਬ ਤੁਹਾਡਾ ਧੰਨਵਾਦ ਹੋਵੇਗਾ ਅਗਰ ਤੁਸੀਂ ਜਲਦ ਤੋਂ ਜਲਦ ਪਹੁੰਚਾਉਂਗੇ